ਕੀ ਤੁਹਾਡੇ ਖੇਤਰ ਵਿੱਚ ਗਾਇਕੀ ਨਾਲ ਸੰਬੰਧਿਤ ਪ੍ਰੋਗਰਾਮ ਹੁੰਦੇ ਹਨ ਜੇਕਰ ਕੋਈ ਪ੍ਰੋਗਰਾਮ ਹੋਏ ਆਏ ਹੋਏ ਹੈ ਤਾਂ ਉਸ ਹਾਲ ਦੱਸੋ ਤੁਸੀਂ ਵਿੱਚ ਜਿਹੜੇ ਜਿਹੜੇ ਗਾਇਕ ਆਏ ਹਨ ਅਤੇ ਉਹਨਾਂ ਕਿਹੜਾ ਗਾਇਕ ਉਸ ਤੋਂ ਸਭ ਤੋਂ ਵਧੀਆ ਲੱਗਦਾ ਹੈ ਹਾਂ ਸਾਡੇ ਖੇਤਰ ਵਿੱਚ ਗਾਇਕ ਨਾਲ ਸੰਬੰਧਿਤ ਪ੍ਰੋਗਰਾਮ ਆਸ਼ਕਾਰ ਹੁੰਦੇ ਹਨ ਅਤੇ ਪਿਛਲੇ ਮਹੀਨੇ ਹੀ ਸਾਡੇ ਸ਼ਹਿਰ ਵਿੱਚ ਇੱਕ ਵੱਡੀ ਸੰਗਤ ਆਮ ਹੋਰ ਹੋਏ ਸੀ ਜਿਸ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਦੇ ਹਿੱਸੇ ਲਏ ਇਸ ਵਿੱਚ ਗੁਰਦਾਸ ਗੁਰਦਾਸ ਮਾਨ ਸਿਕੰਦਰ ਹਰਭਜਨ ਮਾਨ ਵਰਗੇ ਕਲਾਕਾਰ ਨੇ ਆਪਣਾ ਕਲਾਕਾਰ ਪ੍ਰਦਰਸ਼ਨ ਕੀਤਾ ਮੈਨੂੰ ਮਾਣ ਹੈ ਕਿ ਗੁਰਦਾਸ ਮਾਨ ਵੀ ਪੇਸ਼ਕਾਰ ਸਭ ਤੋਂ ਬਾਅਦ ਲੱਗਿਆ ਵਧੀਆ ਲੱਗਾ ਉਹਨਾਂ ਨੇ ਆਵਾਜ਼ ਵਿੱਚ ਇਹ ਅਕਲ ਹੀ ਦੂਜੇ ਜੋ ਸੰਗਤ ਮੰਤਰੀ ਗੁਦ ਵਿੱਚ ਇਹ ਦਿੰਦੇ ਵੇ ਅਤੇ ਉਹਨਾਂ ਨੂੰ ਸੁੱਖ ਗੀਤ ਗਾ ਕੇ ਸਭ ਨੇ ਸਮਝਿਆ ਖੂਬਸੂਰਤ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਅਤੇ ਇੱਧਰ ਨੂੰ ਆਪਣੇ ਮੌਜੂਦਗੀ ਦੀ ਬਹੁਤ ਪ੍ਰਭਾਵਸ਼ਾਲੀ ਸੀ ਉਹਨਾਂ ਨੇ ਆਪਣੀ ਗੱਲਬਾਤ ਦਾ ਸ਼ੁਕਰ ਨਾਲ ਮੰਤਰੀ ਗੁੱਦ ਨਾਲ ਦਿੱਤੀ ਅਤੇ ਗੁਰਦਾਸ ਮਾਨ ਦਾ ਮਸ਼ਕ ਵਿੱਚ ਸਭ ਤੋਂ ਵਧੀਆ ਕਲਾਕਾਰ ਆ ਧੰਨਵਾਦ